ਇੱਕ ਵਾਰ ਮੈਂ ਇੱਕ ਅਜਿਹਾ ਚਿੱਤਰ ਬਣਾਇਆ ਸੀ ਜਿਸ ਵਿੱਚ ਮੈਂ ਇਹ ਦਰਸਾਇਆ ਸੀ ਕਿ ਪਹਿਲਾਂ ਧਰਤੀ ਕਿੰਨੀ ਹਰੀ ਭਰੀ ਸੀ ਅਤੇ ਹੁਣ ਪੋਲਿਊਸ਼ਨ ਅਤੇ ਆਵਾਜਾਈ ਦੇ ਕਾਰਨ ਇਸ ਦਾ ਕੀ ਹਾਲ ਹੋ ਗਿਆ ਹੈ ਪਹਿਲਾਂ ਧਰਤੀ ਕਿੰਨੀ ਹਰੇ ਹਰਿਆਲੀ ਭਰੀ ਸੀ ਅਤੇ ਵਾਤਾਵਰਨ ਕਿੰਨਾ ਖੁਸ਼ਨੁਮਾ ਅਤੇ ਹਵਾ ਕਿੰਨੀ ਵਧੀਆ ਸੀ ਪਰ ਅੱਜ ਕੱਲ੍ਹ ਦੇ ਟਾਈਮ ਵਿੱਚ ਹਵਾ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ ਅਤੇ ਵਾਤਾਵਰਨ ਵੀ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ ਅੱਜ ਕੱਲ੍ਹ ਇਹੋ ਜਿਹੇ ਹਾਲਾਤ ਬਹੁਤ ਹੀ ਘੱਟ ਰਹਿ ਗਏ ਹਨ ਕਿ ਇੱਕ ਇਨਸਾਨ ਇਸ ਧਰਤੀ 'ਤੇ ਜ਼ਿਆਦਾ ਟਾਈਮ ਜੀਵਨ ਬਤੀਤ ਕਰ ਸਕੇ ਕਿਉਂਕਿ ਅੱਜ ਕੱਲ੍ਹ ਹਰ ਇੱਕ ਕੋਲ ਮੋਟਰਸਾਈਕਲਾਂ ਅਤੇ ਗੱਡੀ ਹਨ ਜਿਸ ਨੂੰ ਜਿਸ ਤੋਂ ਧੂੰਆਂ ਨਿਕਲਣ ਵਾਲਾ ਧੂੰਆਂ ਬਹੁਤ ਸਾਰੀ ਬਿਮਾਰੀਆਂ ਪੈਦਾ ਕਰਦਾ